ਹਾਂਜੀ ਮੇਰਾ ਮੈਨੂੰ ਪੇਂਟਿੰਗ ਕਰਨਾ ਬਹੁਤ ਵਧੀਆ ਲੱਗਦਾ ਹੈ ਸਾਡੇ ਨੇੜੇ ਹਾਂਜੀ ਇੱਕ ਹੈ ਮਹਿਲਾ ਵੀ ਉਹ ਘਰ ਵਿੱਚ ਹੀ ਸਿਲਾਈ ਸੈਂਟਰ ਔਰ ਪੇਂਟਿੰਗ ਸੈਂਟਰ ਖੋਲ੍ਹਿਆ ਹੈ ਜੋ ਕਿ ਕੁੜੀਆਂ ਨੂੰ ਮੁੱਢਲੀ ਪੇਂਟਿੰਗ ਸਿੱਖਿਆ ਔਰ ਸਿਲਾਈ ਸਿੱਖਿਆ ਦਿੰਦੀ ਹੈ ਮੈਂ ਵੀ ਉਹਨਾਂ ਕੋਲ ਜਾਂਦੀ ਹਾਂ ਸਟੇਸ਼ਨਰੀ ਦੀਆਂ ਕੁਛ ਚੀਜ਼ਾਂ ਵੀ ਉਹਦੇ ਕੋਲ ਹੁੰਦੀਆਂ ਹਨ ਜਿਵੇਂ ਕਿ ਪੇਂਟਿੰਗ ਨੂੰ ਹੀ ਲੈ ਕੇ ਚੱਲਦੇ ਹਾਂ ਪੇਂਟਿੰਗ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਪੇਂਟਿੰਗਜ਼ ਕਲਰ ਚਾਹੀਦੇ ਨੇ ਇੱਕ ਰਫ ਕੱਪੜਾ ਚਾਹੀਦਾ ਏ ਆ ਜਿਹਦੇ ਵਿੱਚ ਆਪਾਂ ਕਲਰ ਮਿਕਸਿੰਗ ਕਰਦੇ ਹਾਂ ਪੇਂਟਿੰਗ ਜਿਵੇਂ ਮਤਲਬ ਮੇਰੇ ਕੋਲ ਮੈਨੂੰ ਤਾਂ ਪੇਂਟਿੰਗ ਬਹੁਤ ਵਧੀਆ ਆਉਂਦੀ ਹੈ ਪੇਂਟਿੰਗ ਦੇ ਵਿੱਚ ਮੈਂ ਜ਼ਿਆਦਾਤਰ ਸੂਟ 'ਤੇ ਪੇਂਟ ਕਰਨਾ ਜਾਂ ਵੋਲ ਪੇਂਟਿੰਗ ਹੀ ਪਸੰਦ ਕਰਦੀ ਹਾਂ ਮੇਰੇ ਕੋਲ ਕਾਫੀ ਆਪਣੇ ਘਰ ਵਿੱਚ ਪੇਂਟਿੰਗਜ਼ ਬਣਾਈਆਂ ਲਗਾਈਆਂ ਵੀ ਹੋਈਆਂ ਵੋਲ 'ਤੇ ਔਰ ਦੋ ਤਿੰਨ ਸੂਟ ਵੀ ਪੇ ਪੇਂਟ ਕੀਤੇ ਹੋਏ ਨੇ ਪੇਂਟਿੰਗ ਲਈ ਸਭ ਤੋਂ ਪਹਿਲਾਂ ਤਾਂ ਕਲਰਜ਼ ਦੀ ਕਲਰ ਚਾਹੀਦੇ ਨੇ ਕਲਰ ਦੇ ਵਿੱਚ ਮਿਕਸਿੰਗ ਆਉਣੀ ਚਾਹੀਦੀ ਹੈ ਕਲਰ ਨੂੰ ਕਿਵੇਂ ਮਿਕਸ ਕਰ ਸਕਦੇ ਹਾਂ ਪੇਂਟਿੰਗ ਦੇ ਕਲਰ ਚਾਹੀਦੇ ਨੇ ਔਰ ਬਰੱਸ਼ ਚਾਹੀਦਾ ਸਭ ਤੋਂ ਜਰੂਰੀ ਉਸ ਤੋਂ ਬਾਅਦ ਆਪਾਂ ਨੂੰ ਇੱਕ ਮਾਰਕਰ ਚਾਹੀਦਾ ਏ ਆ ਪੇਂਟਿੰਗ ਲਈ ਪੈੱਨ ਚਾਹੀਦਾ ਆ ਇੱਕ ਟਰੇਸ ਪੇਪਰ ਟਰੇਸ ਪੇਪਰ 'ਤੇ ਇਹ ਹੈ ਵੀ ਕੋਈ ਵੀ ਆਪਾਂ ਡਿਜ਼ਾਈਨ ਟਰੇਸ ਕਰ ਸਕਦੇ ਹਾਂ ਪਹਿਲਾਂ ਆਰਾਮ ਦੇ ਨਾਲ ਪੈਨਸਲ ਦੇ ਨਾਲ ਪੈਨਸਲ ਦੇ ਨਾਲ ਟਰੇਸ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਸੂਈ ਦੇ ਨਾਲ ਬਰੀਕ ਬਰੀਕ ਹੋਲ ਛੋਟੇ ਛੋਟੇ ਕਰ ਦੇਣੇ ਆ ਬਰੀਕ ਹੋਲ ਹੋਲ ਉਸ ਤੋਂ ਬਾਅਦ ਉਸਨੂੰ ਆਪਣੇ ਕੱਪੜੇ 'ਤੇ ਵਿਛਾ ਦਓ ਕੱਪੜੇ 'ਤੇ ਵਿਛਾਉਣ ਤੋਂ ਬਾਅਦ ਉਸ 'ਤੇ ਮਾਰਕਰ ਦੇ ਨਾਲ ਉਸ 'ਤੇ ਡਿਜ਼ਾਇਨ ਛਪ ਜਾਂਦਾ ਹੈ ਸੂਟ ਹੋ ਗਿਆ ਜਾਂ ਕੋਈ ਵੇਸਟ ਕੱਪੜਾ ਲਾ ਕੇ ਚਲੋ ਉਸ 'ਤੇ ਉਹ ਛਪ ਜਾਂਦਾ ਹੈ ਉਸ ਤੋਂ ਬਾਅਦ ਕਲ ਆ ਗਈ ਕਲਰ ਮਿਕਸਿੰਗ ਦੀ ਗੱਲ ਵੀ ਉਸ ਕੱਪੜੇ 'ਤੇ ਕਿਹੜੇ ਕਿਹੜੇ ਕਲਰ ਵਧੀਆ ਲੱਗਦੇ ਨੇ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਕਲਰ ਨੂੰ ਮਿਕਸ ਕੀਤਾ ਜਾਂਦਾ ਹੈ ਡਿਜ਼ਾਇਨ ਵਧੀਆ ਚੁਣ ਲਓ ਜੇ ਸੂਟ ਆ ਆਹ ਕੋਈ ਫਲਾਵਰ ਹੋ ਗਏ ਕੋਈ ਸਿਨਰੀ ਹਲਕੀ ਮੋਟੀ ਹੋ ਗਈ ਕੁਛ ਇੱਦਾਂ ਦਾ ਸੀਨ ਬਣਾ ਲਿਆ ਜਾਂਦਾ ਹੈ ਵੋਲ ਪੇਂਟਿੰਗ ਦੇ ਵਿੱਚ ਵੀ ਮੈਂ ਕਾਫੀ ਪੇਂਟਿੰਗਸ ਕੀਤੀਆਂ ਜਿਵੇਂ ਇੱਕ ਨਿਊ ਬਰਾਈਡਲ ਦੀ ਪੇਂਟਿੰਗ ਕੀਤੀ ਸੀ ਇੱਕ ਬੋਆਏਜ਼ ਆਪਣੇ ਪੇਰੈਂਟਸ ਨੂੰ ਲੈ ਕੇ ਜਾ ਰਹੇ ਇੱਕ ਬੱਚਾ ਮਤਲਬ ਪੇੜ ਦੇ ਨੀਚੇ ਸਟੱਡੀ ਕਰ ਰਿਹਾ ਹਨੇਰੇ ਦੇ ਵਿੱਚ ਸਟਰੀਟ ਲਾਈਟ ਲੱਗੀ ਹੋਈ ਹੈ ਐਵੇਂ ਦੀਆਂ ਮੈਂ ਮਤਲਬ ਕਿ ਪੇਂਟਿੰਗਸ ਕਾਫੀ ਪਸੰਦ ਕੀਤੀਆਂ ਏ ਮੈਨੂੰ ਮਤਲਬ ਪੇਂਟਿੰਗ ਫ੍ਰੀ ਟਾਈਮ 'ਤੇ ਪੇਂਟਿੰਗ ਸਟੀਚਿੰਗ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਕਰਨੀਆਂ ਅੱਜ ਕੱਲ੍ਹ ਵੈਸੇ ਵੀ ਸੂਟਾਂ 'ਤੇ ਪੇਂਟਿੰਗ ਦਾ ਕਾਫੀ ਜ਼ਿਆਦਾ ਟਰੈਂਡ ਚੱਲ ਰਿਹਾ ਔਨਲਾਈਨ ਵੀ ਤੁਸੀਂ ਬਹੁਤ ਦੇਖ ਰਹੇ ਹੋ ਵੀ ਪੇਂਟਿੰਗ ਕਾਫੀ ਲੋਕ ਜ਼ਿਆਦਾ ਕਰ ਰਹੇ ਨੇ ਸੂਟਾਂ 'ਤੇ ਕਾਫੀ ਚਾਰਜਸ ਵੀ ਮਤਲਬ ਬੁਟੀਕਸ ਤੋਂ ਲਏ ਜਾਂਦੇ ਨੇ ਜੋ ਕਿ ਮੈਂ ਆਪਣਾ ਆਰਾਮ ਦੇ ਨਾਲ ਘਰ ਕਰਕੇ ਵੇਅਰ ਕਰ ਸਕਦੀ ਹਾਂ ਅਤੇ ਮੈਨੂੰ ਖੁਸ਼ੀ ਵੀ ਹੈ ਵੀ ਮੈਨੂੰ ਇਹ ਹੁਨਰ ਮੇਰੇ ਵਿੱਚ ਹੈ